ਮੈਨੂੰ ਬਾਈਕਿੰਗ ਕਰਨ ਦਾ ਸ਼ੌਕ ਨੌਵੀਂ ਜਮਾਤ ਤੋਂ ਹੀ ਹੈ ਅਤੇ ਮੈਂ ਆਪਣੇ ਪਿਤਾ ਜੀ ਤੋਂ ਬਾਈਕਿੰਗ ਕਰਨੀ ਸਿੱਖ ਲਈ ਸੀ ਅਤੇ ਇਹ ਸਿਹਤ ਲਈ ਬਹੁਤ ਹੀ ਜ਼ਿਆਦਾ ਮੈਨੂੰ ਵਧੀਆ ਵੀ ਲੱਗਦਾ ਹੈ ਜਦੋਂ ਵੀ ਮੈਂ ਆਪਣੇ ਕੰਮਾਂ ਤੋਂ ਬਹੁਤ ਹੀ ਜ਼ਿਆਦਾ ਬੋਰ ਹੋ ਜਾਂਦੀ ਹਾਂ ਅਤੇ ਆਪਣੀ ਰੂਹ ਨੂੰ ਸਕੂਨ ਦੇਣ ਦੇ ਲਈ ਮੈਂ ਪਹਾੜਾਂ ਦੇ ਵੱਲ ਬਾਈਕਿੰਗ ਕਰਨ ਲਈ ਚਲੀ ਜਾਂਦੀ ਹਾਂ ਜਦੋਂ ਵੀ ਮੈਂ ਬਾਈਕਿੰਗ ਕਰਨ ਬਾਰੇ ਸੋਚਦੀ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਮੌਸਮ ਦਾ ਧਿਆਨ ਰੱਖਦੀ ਹਾਂ ਕਿ ਕਿਸ ਟਾਈਮ 'ਤੇ ਮੈਨੂੰ ਜਾਣਾ ਚੰਗਾ ਰਹੇਗਾ ਤਾਂ ਕਿ ਮੇਰੇ ਰਸਤੇ ਦੇ ਵਿੱਚ ਜ਼ਿਆਦਾ ਰੁਕਾਵਟਾਂ ਨਾ ਆਉਣ ਤਾਂ ਮੈਂ ਆਪਣੇ ਮੋਬਾਈਲ ਫੋਨ 'ਤੇ ਸਾਰਾ ਰਸਤੇ ਦਾ ਵੀ ਪਲੈਨ ਕਰ ਲੈਦੀ ਹਾਂ ਕਿ ਕਦੋਂ ਕਿੱਥੇ ਕਿਵੇਂ ਜਾਣਾ ਹੈ ਆਮ ਤੌਰ 'ਤੇ ਮੈਂ ਆਪਣੇ ਨਾਲ ਇੱਕ ਟੈਂਟ ਰੱਖ ਲੈਦੀ ਹਾਂ ਤਾਂ ਕਿ ਜੇਕਰ ਕਿਤੇ ਮੈਨੂੰ ਰੁਕਣਾ ਪੈ ਜਾਵੇ ਤਾਂ ਮੈਂ ਉੱਥੇ ਆਸਾਨੀ ਦੇ ਨਾਲ ਆਪਣਾ ਰਾਤ ਨੂੰ ਰਹਿ ਸਕਾਂ ਅਮ ਜਿੱਦਾਂ ਕਿ ਰਸਤੇ ਦੇ ਵਿੱਚ ਕੋਈ ਅਵਾਰਾ ਕੁੱਤੇ ਜਾਂ ਮੈਨੂੰ ਕੋਈ ਜਾਨ ਨੂੰ ਖਤਰਾ ਹੋਣ ਤੋਂ ਮੈਂ ਆਪਣਾ ਬਚਾਅ ਕਰਨ ਦੇ ਲਈ ਆਪਣੇ ਨਾਲ ਕੋਈ ਚਾਕੂ ਜਾਂ ਫਿਰ ਸੋਟੀ ਜ਼ਰੂਰ ਰੱਖਦੀ ਹਾਂ ਅਤੇ ਮੈਂ ਆਪਣਾ ਘਰੋਂ ਤੁਰਨ ਵੇਲੇ ਆਪਣਾ ਪਾਣੀ ਦੀ ਬੋਤਲ ਅਤੇ ਖਾਣ ਦਾ ਸਾਰਾ ਜੋ ਵੀ ਸਨੈਕਸ ਵਗੈਰਾ ਹੁੰਦੇ ਹਨ ਉਹ ਵੀ ਸਾਰੇ ਆਪਣੇ ਨਾਲ ਰੱਖਦੀ ਹਾਂ ਇਸ ਤਰ੍ਹਾਂ ਇਹ ਗੱਲਾਂ ਦਾ ਧਿਆਨ ਰੱਖਣ ਦੇ ਨਾਲ ਸਭ ਕੁਛ ਇਹਨਾਂ ਦੀ ਪਾਲਣਾ ਕਰਕੇ ਮੈਂ ਆਪਣਾ ਬਾਈਕਿੰਗ ਦੇ ਲਈ ਨਿਕਲ ਜਾਂਦੀ ਹਾਂ ਅਤੇ ਜੋ ਵੀ ਮੇਰਾ ਸਾਰਾ ਸਫਰ ਹੁੰਦਾ ਹੈ ਉਹ ਬਹੁਤ ਹੀ ਆਸਾਨੀ ਨਾਲ ਲੰਘ ਜਾਂਦਾ ਹੈ ਜ ਜੇਕਰ ਕਿਤੇ ਮੈਨੂੰ ਲੋੜ ਪੈਂਦੀ ਹੈ ਤਾਂ ਮੈਂ ਰਸਤੇ ਦੇ ਵਿੱਚ ਆਪਣਾ ਸਫਰ ਰੋਕ ਕੇ ਉੱਥੋਂ ਆਪਣੀ ਜੋ ਲੋੜ ਹੁੰਦੀ ਹੈ ਪੂਰੀ ਕਰਕੇ ਆਪਣੀ ਬਾਈਕਿੰਗ ਦੀ ਜੋ ਯਾਤਰਾ ਹੁੰਦੀ ਹੈ ਉਹਨੂੰ ਫਿਰ ਤੋਂ ਆਪਣੀ ਸ਼ੁਰੂ ਕਰ ਦਿੰਦੀ ਹਾਂ